ਕਾਰੋਬਾਰ ਵਿੱਚ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਹੈ ਤਕਨੀਕ ਕਾਰਨ ਅਸੀਂ ਆਪਣੇ ਕਾਰੋਬਾਰ ਨੂੰ ਬਹੁਤ ਵਧਾ ਸਕਦੇ ਹਾਂ ਤਕਨੀਕ ਜਿਵੇਂ ਕੀ ਮਸ਼ੀਨਾਂ ਰਾਹੀਂ ਸਮਾਨ ਨੂੰ ਤਿਆਰ ਕਰ ਸਕਦੇ ਹਾਂ ਅਤੇ ਟਰੱਕਾਂ ਰਾਹੀਂ ਅਸੀਂ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਲਦੀ ਪਹੁੰਚਾ ਸਕਦੇ ਹਾਂ ਇੰਟਰਨੈਟ ਰਾਹੀਂ ਅਸੀਂ ਘਰ ਬੈਠੇ ਹੀ ਆਪਣੇ ਕਾਰੋਬਾਰ ਦਾ ਆਨੰਦ ਲੈ ਸਕਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿੱਲ ਦਾ ਭੁਗਤਾਨ ਕਰ ਸਕਦੇ ਹਾਂ ਆਪਸ ਵਿੱਚ ਅਸੀਂ ਫੋਨ ਰਾਹੀਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ ਧੰਨਵਾਦ